ਹੈਲੋ ਵਧੀਆ ਭਾਅ ਜੀ ਤੁਸੀਂ ਦੱਸੋ ਓਹ ਹਾਂਜੀ ਮੇਰੀ ਵੀ ਐਜੂਕੇਸ਼ਨ ਪੂਰੀ ਹੋਈ ਨੂੰ ਪੂਰਾ ਸਾਲ ਹੀ ਹੋ ਗਿਆ ਛੇ ਕੁ ਮਹੀਨੇ ਹੋ ਗਏ ਆ ਮੈਂ ਸੋਚਣ ਡਿਆਂ ਕੋਈ ਬਿਜ਼ਨਸ ਸ਼ੁਰੂ ਕਰ ਲਈਏ ਹੈਂ ਜੀ ਜੋਬ ਦਾ 'ਤੇ ਨਹੀਂ ਅਪਲਾਈ ਕੀਤਾ ਹਜੇ ਮੈਂ ਉੱਦਾਂ ਬਿਜ਼ਨਸ ਕਰਨ ਦ ਸੋਚਣ ਡਿਆ ਹਾਂ ਹਾਂਜੀ ਓਕੇ ਕਰ ਲੈਂਦੇ ਹਾਂ ਆਪਾਂ ਹਾਂਜੀ ਹਾਂਜੀ ਹਾਂਜੀ ਤਰਨ ਤਾਰਨ ਆਪਾਂ ਬੇਬੂ ਸ਼ਾਹ ਮਾਰਕੀਟ 'ਚ ਹੀ ਕਰ ਲਾਂਗੇ ਉੱਥੇ ਤੁਹਾਨੂੰ ਪਤਾ ਮੋਬਾਈਲ ਦੀ ਮਾ ਮੋਬਾਈਲ ਦੀ ਮਾਰਕੀਟ ਆ ਓਹ ਹਾਂਜੀ ਰੈਂਟ ਦੇ ਉੱਤੇ ਮਿਲ ਜਾਣੀ ਆ ਦਸ ਪੰਦਰਾਂ ਹਜ਼ਾਰ 'ਚ ਹਾਂਜੀ ਉਹ ਮਾਰਕੀਟ ਹੀ ਆ ਨਾ ਉਹਨਾਂ ਦੀ ਮੋਬਾਈਲਸ ਦੀ ਮਾਰਕੀਟ ਕੋਈ ਕੋਈ ਨਹੀਂ ਮਿਲ ਜਾਣੀ ਓਕੇ